ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਵਪਾਰਕ ਖੇਤਰ ਨਵੀਨਤਾ ਜਾਂ ਸਿ ਸਿਰਜਣਾ ਤਾਮਕਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਤਰੀਕੇ ਹਨ ਜੋ ਸਰਕਾਰ ਉਦਯੋਗੀ ਅਤੇ ਸਮਾਜ ਦੇ ਸਹਿਯੋਗ ਦਾ ਸੰਭਾਵਨਾਵਾਂ ਪੈਦਾ ਕਰ ਸਕਦੀਆਂ ਹਨ ਪੰਜਾਬ ਸਰਕਾਰ ਨੂੰ ਨਵੀਤਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਕੁਝ ਕਰਨਾ ਪਿੰਡਾਂ ਜਾਂਦਾ ਹੈ ਪੰਜਾਬ ਸਰਕਾਰ ਨੇ ਵਪਾਰਕ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਵਡਾਵਾ ਦੇਣ ਲਈ ਨਵੀਨਤਾ ਨੂੰ ਸਪੋਰਟ ਕਰਨ ਵਾਲੀਆਂ ਮੁ ਮੁਦਰਾਵਾਂ ਤਿਆਰ ਕੀਤੀਆਂ ਹਨ ਸਰਕਾਰ ਨੇ ਖੇਤਰ ਵਿੱਚ ਨਵੀਨਤਾ ਨੂੰ ਵਡਾਵਾ ਦੇਣ ਲਈ ਕੁਦਰਤੀ ਸਿੱਖਿਆ ਅਤੇ ਸ ਸੱਚਕਤਾ ਨੂੰ ਪ੍ਰਮੋਟ ਕਰਨ ਵਾਲੇ ਯੋਜਨਾਵਾਂ ਚਾਲੂ ਕੀਤੀਆਂ ਹਨ ਇਸ ਤਰੀਕੇ ਨਾਲ਼ ਉਦਯੋਗਾਂ ਨੂੰ ਨਵੀਨਤਾ ਨੂੰ ਸ਼ਕੀਨ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਨਵੀਨ ਉਦਾਰਵਾਦੀ ਵਿਚਾਰਧਾਰਾ ਨੂੰ ਵਡਾਵਾ ਮਿਲ ਰਿਹਾ ਹੈ ਸਹੀ ਸਰਕਾਰੀ ਪ੍ਰੋਗਰਾਮਾਂ ਵਿੱਚ ਸਹਾਇਤਾ ਨਾਲ਼ ਉਦਯੋਗੀਆਂ ਨੂੰ ਨਵੀਤਾ ਨੂੰ ਵਧਾਉਣ ਲਈ ਆਤਮ ਵਿਸ਼ਵਾਸ ਬੜਾਉਣ ਦਾ ਇੱਕ ਸਾ ਸਾਡਾ ਰਾਸ਼ਟਰ ਮਿਲ ਰਿਹਾ ਸਰਕਾਰ ਅਤੇ ਜਿਵੇਂ ਕਿ ਵਿਕਾਸਸ਼ੀਲ ਪੰਜਾਬ ਯੋਜਨਾ ਦੁਆਰਾ ਕੌਣ ਸਾਈਡ ਅਤੇ ਨਵੀਨਤਾ ਨੂੰ ਸਮਰਥਕ ਕਰਨ ਵਿੱਚ ਮਦਦ ਕਰਦੇ ਹਨ ਜੋ ਨਵੀਨਤਾ ਦੀ ਪੈਦਾਵਾਰ ਨੂੰ ਵਡਾਵਾ ਦੇ ਰਹੇ ਹਨ ਧੰਨਵਾਦ ਜੀ